ਤਕਨੌਲਜੀ ਨੇ ਬੈਂਕਿੰਗ ਨੂੰ ਕੁਝ ਇਸ ਤਰ੍ਹਾਂ ਅਸਾਨ ਬਣਾ ਦਿੱਤਾ ਹੈ ਕਿਉਂਕਿ ਜਿਉਂ ਜਿਉਂ ਨਵੀਆਂ ਨਵੀਆਂ ਬੈਂਕਿੰਗ ਦੀਆਂ ਐਪਸ ਜੋ ਕਿ ਪਲੇਅ ਸਟੋਰ 'ਤੇ ਆ ਰਹੀਆਂ ਹਨ ਇਸ ਦੇ ਰਾਹੀਂ ਅਸੀਂ ਆਪਣਾ ਬੈਂਕ ਅਕਾਊਂਟ ਜਿਵੇਂ ਟਰਾਜੈਕਸ਼ਨਸ ਆਦਿ ਵਗੈਰਾ ਗੂਗਲ ਪਲੇਅ ਸਟੋਰ ਤੋਂ ਐਪ ਡਾਊਨਲੋਡ ਕਰਕੇ ਗੂਗਲ ਪੇ ਪੇਟੀਅਮ ਐੱਸ ਬੀ ਆਈ ਹਰੇਕ ਬੈਂਕ ਨੇ ਆਪਣਾ ਅਲੱਗ ਤੋਂ ਵੱਖਰਾ ਐਪ ਲੌਂਚ ਕਰ ਦਿੱਤਾ ਹੈ ਜਿਸ ਦੇ ਰਾਹੀਂ ਆਪਣਾ ਸਾਰੀਆਂ ਟਰਾਜੈਕਸ਼ਨ ਆਦਿ ਵਗੈਰਾ ਚੈੱਕ ਕਰ ਸਕਦੇ ਹਾਂ ਅਗਰ ਸਾਨੂੰ ਲੋਨ ਵੀ ਚਾਹੀਦਾ ਨਾ ਤਾਂ ਉਹ ਵੀ ਅਸੀਂ ਮਿੰਟਾਂ ਸਕਿੰਟਾਂ ਵਿੱਚ ਘਰ ਬੈਠੇ ਅਪਲਾਈ ਕਰ ਸਕਦੇ ਹਾਂ ਇਸ ਕਾਰਨ ਤਕ ਜਿਵੇਂ ਤਕਨੌਲਜੀ ਨੇ ਸਾਡੇ ਵਿੱਚ ਬਹੁਤ ਅਸਾਨ ਬਣਾ ਦਿੱਤਾ ਹੈ ਬੈਂਕਿੰਗ ਨੂੰ ਮਨੁੱਖ ਦੀ ਦਖ਼ਲ ਅੰਦਾਜ਼ੀ ਤਾਂ ਇੱਦਾਂ ਹੈ ਵੀ ਪਹਿਲਾਂ ਬੈਂਕਾਂ ਦੇ ਵਿੱਚ ਲੈਨਾਂ ਲਗਾਉਣੀਆਂ ਪੈਂਦੀਆਂ ਸੀ ਅਤੇ ਹੁਣ ਸਾਰਾ ਕੁਛ ਘਰ ਬੈਠੇ ਹੀ ਹੋ ਜਾਂਦਾ ਹੈ ਜਿਸ ਕਾਰਨ ਮਨੁੱਖ ਦੀ ਕਾਢ ਨੇ ਕੋਈ ਉਲਝਣ ਪੈਦਾ ਨਹੀਂ ਕੀਤੀ